ਮੈਨੂੰ ਤੈਰਾਕੀ ਦਾ ਬਹੁਤ ਸ਼ੌਕ ਹੈ ਪਰ ਤੈਰਾਕ ਕਰਨ ਲਈ ਸਭ ਤੋਂ ਵਧੀਆ ਮੈਨੂੰ ਵਾਟਰ ਪਾਰਕ ਚੰਗੇ ਲੱਗਦੇ ਹਨ ਕਿਉਂਕਿ ਵਾਟਰ ਪਾਰਕ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਤਿੰਨ ਜਾਂ ਚਾਰ ਸਵੀਮਿੰਗ ਪੂਲ ਮੌਜੂਦ ਹੁੰਦੇ ਹਨ ਜਿਹੜੇ ਬਹੁਤ ਵਧੀਆ ਤਰੀਕੇ ਨਾਲ ਤੈਰ ਲੈਂਦੇ ਹਨ ਉਹਨਾਂ ਵਾਸਤੇ ਡੂੰਘੇ ਪਾਣੀ ਵਾਲੇ ਸਵੀਮਿੰਗ ਪੂਲ ਅਤੇ ਜਿਨ੍ਹਾਂ ਨੂੰ ਥੋੜ੍ਹੀ ਘੱਟ ਜਾਂਚ ਹੈ ਜਾਂ ਉਹ ਪ੍ਰੈਕਟਿਸ ਕਰ ਰਹੇ ਨੇ ਹਜੇ ਉਹਨਾਂ ਵਾਸਤੇ ਘੱਟ ਪਾਣੀ ਵਾਲੇ ਸਵੀਮਿੰਗ ਪੂਲ ਹੁੰਦੇ ਹਨ ਇਸ ਤੋਂ ਇਲਾਵਾ ਬਹੁਤ ਹੀ ਵਧੀਆ ਗਾਰਡ ਉੱਥੇ ਲੋਕਾਂ ਦੀ ਸੇਫਟੀ ਵਾਸਤੇ ਮੌਜੂਦ ਰਹਿੰਦੇ ਹਨ ਜਦੋਂ ਤੈਰਾਕੀ ਕਰਦੇ ਸਮੇਂ ਕੋਈ ਕਿਸੇ ਦੁਰਘਟਨਾ ਦਾ ਸ਼ਿਕਾਰ ਹੋਣ ਲੱਗਦਾ ਹੈ ਜਾਂ ਹੋ ਜਾਂਦਾ ਹੈ ਤਾਂ ਉਸੇ ਵੇਲੇ ਉਹਦੀ ਹੈਲਪ ਕਰਨ ਲਈ ਆ ਜਾਂਦੇ ਹਨ ਇਸ ਤੋਂ ਇਲਾਵਾ ਜਿਹੜੇ ਵਾਟਰ ਪਾਰਕ ਹੁੰਦੇ ਹਨ ਉਥੋਂ ਦੇ ਜਿਹੜੇ ਸਵੀਮਿੰਗ ਪੂਲ ਹੁੰਦੇ ਹਨ ਉਹਨਾਂ ਦੇ ਪਾਣੀ ਦਾ ਲੈਵਲ ਬਕਾਇਦਾ ਚੈੱਕ ਕੀਤਾ ਜਾਂਦਾ ਹੈ ਉੱਥੋਂ ਦੇ ਪਾਣੀ ਦੀ ਕੁਆਲਿਟੀ ਸਫਾਈ ਦਾ ਧਿਆਨ ਰੱਖਿਆ ਜਾਂਦਾ ਹੈ ਉਸ ਵਿੱਚ ਜ਼ਰੂਰੀ ਮੈਡੀਸਨ ਜਿਸ ਦੇ ਨਾਲ ਕਿਸੇ ਨੂੰ ਕੋਈ ਇਨਫੈਕਸ਼ਨ ਵਗੈਰਾ ਨਾ ਹੋਵੇ ਔਰ ਸਹੀ ਮਾਤਰਾ ਵਿੱਚ ਪਾਈ ਜਾਂਦੀ ਹੈ ਜਿਸ ਦੇ ਨਾਲ ਕਿ ਤੈਰਾਕ ਕਰਨ ਵਾਲੇ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਉਸ ਦਾ ਕੋਈ ਫਿਜੀਕਲ ਜਾਂ ਸਕਿੰਨ ਲੋਸ ਨਹੀਂ ਹੁੰਦਾ ਇਸ ਲਈ ਮੈਨੂੰ ਵਾਟਰ ਪਾਰਕ ਬਹੁਤ ਵਧੀਆ ਲੱਗਦੇ ਹਨ